ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੇਰੀ ਮੰਮੀ ਨੇ ਇੱਕ ਸਿਨਰੀ ਬਣਾਈ ਸੀਗੀ ਜੋ ਸਿਨਰੀ ਮੈਨੇ ਜੋ ਇੱਕ ਸਿ ਸਿਨਰੀ ਬਣਾਈ ਸਿਨਰੀ ਮੈਂ ਖ਼ਰਾਬ ਕਰ ਦਿੱਤੀ ਤਾਂ ਉਸ ਵਿੱਚ ਮੈਂ ਮੋਤੀ ਮੋਤੀ ਵਗੈਰਾ ਸੂਈ ਨਾਲ ਲਗਾ ਦਿੱਤੇ ਤਾਂ ਮੰਮੀ ਨੇ ਮੈਨੂੰ ਬਹੁਤ ਗਾਲਾਂ ਦਿੱਤੀਆਂ ਉਹ ਸਿਨਰੀ ਬਿਲਕੁਲ ਖ਼ਰਾਬ ਹੋ ਗਈ ਸੀਗੀ ਮੰਮੀ ਹਾਲੇ ਵੀ ਯਾਦ ਕਰਦੇ ਆ ਕਿ ਤੂੰ ਮੇਰੀ ਉਹ ਸਿਨਰੀ ਬਹੁਤ ਵਧੀਆ ਬਣਾਈ ਹੋਈ ਸੀ ਜੋ ਤੂੰ ਖ਼ਰਾਬ ਕਰਤੀ ਸਿਨਰੀ ਹੈ ਪੇਂਟਿੰਗ ਸਿਨਰੀ ਉੱਤੇ ਪੇਟਿੰਗ ਪੇਂਟਿੰਗ ਕਰਨੀ ਸੀਗੀ ਅਤੇ ਮੈਂ ਮੈਂ ਸਾਰੇ ਸਿੱਪੀਆਂ ਮੋਤੀ ਲਾਤੇ ਅਤੇ ਉਹ ਸਿਨਰੀ ਖ਼ਰਾਬ ਹੋ ਗਈ